ਮੌਜੂਦਾ ਪੌਦਿਆਂ ਦੇ ਵਿੱਚ ਅਗਰ ਮੈਂ ਗੱਲ ਕਰਾਂ ਆਪਣੇ ਛੋਟੇ ਜਿਹੇ ਕਿਚਨ ਗਾਰਡਨ ਦੀ ਤਾਂ ਉਹਦੇ ਵਿੱਚ ਬੈਂਗਣ ਭਿੰਡੀ ਕੱਦੂ ਘੀਆ ਤੋਰੀਆਂ ਅਤੇ ਟਮਾਟਰ ਆਦਿ ਜਿਹੜੀਆਂ ਸਬਜ਼ੀਆਂ ਹਨ ਉਹ ਹਰ ਮੌਸਮ ਵਿੱਚ ਮੈਂ ਉਗਾਉਂਦੀ ਹਾਂ ਅਤੇ ਉਹਦੇ ਵਿੱਚ ਜਦੋਂ ਉਹਨਾਂ ਤੋਂ ਹੋਰ ਪੌਦੇ ਪੈਦਾ ਕਰਨ ਦੇ ਲਈ ਉਹਨਾਂ ਦੇ ਜਿਹੜੇ ਬੀਜ ਹਨ ਉਹਨਾਂ ਨੂੰ ਕੱਢ ਕੇ ਰੱਖ ਲਿਆ ਜਾਂਦਾ ਹੈ ਜਿਵੇਂ ਕਿ ਕੋਈ ਮੰਨ ਲਓ ਤੋਰੀ ਹੈ ਤਾਂ ਉਸ ਨੂੰ ਪੂਰੀ ਤਰ੍ਹਾਂ ਪਕਾ ਕੇ ਰੱਖ ਲੈਣਾ ਪੂਰੀ ਦੀ ਪੂਰੀ ਪੂਰੀ ਤੋਰੀ ਰੱਖ ਲੈਣੀ ਅਤੇ ਉਹ ਇੱਕ ਸਾਲ ਦੋ ਸਾਲ ਇਸ ਤਰ੍ਹਾਂ ਹੀ ਤੁਸੀਂ ਸਟੋਰ ਕਰਕੇ ਅਗਰ ਉਸਨੂੰ ਤੁਸੀਂ ਸੰਭਾਲ ਕੇ ਰੱਖਦੇ ਹੋ ਤਾਂ ਉਸਨੂੰ ਜਦੋਂ ਮਰਜ਼ੀ ਬੀ ਕੱਢੋ ਅਤੇ ਉਹਨਾਂ ਬੀਆਂ ਨੂੰ ਤੁਸੀਂ ਧਰਤੀ ਦੇ ਵਿੱਚ ਗੱਡ ਕੇ ਪਾਣੀ ਦੇ ਕੇ ਉਹ ਦੁਬਾਰਾ ਤੋਂ ਫਿਰ ਤੋਂ ਜਿਹੜੇ ਨਵੇਂ ਬੂਟੇ ਹਨ ਉਹ ਨਵੇਂ ਪੌਦੇ ਹਨ ਉਹ ਪੈਦਾ ਹੋ ਜਾਂਦੇ ਹਨ ਅਤੇ ਅਸੀਂ ਜਿਹੜੇ ਪੌਦੇ ਜਿਹੜੇ ਮੈਂ ਉਗਾਉਂਦੀ ਹਾਂ ਮੰਨ ਲਓ ਹਰਾ ਧਨੀਆ ਹੈ ਮੇਥੀ ਹੈ ਮੇਥੇ ਹਨ ਹੋਰ ਸਬਜ਼ੀਆਂ ਹਨ ਜਾਂ ਜਿਹੜੇ ਫਲ ਹਨ ਤਾਂ ਉਹਨਾਂ ਪੌਦਿਆਂ ਦੀ ਵਰਤੋਂ ਮੈਂ ਆਪਣੇ ਕਿਚਨ 'ਚ ਕਰਦੀ ਹਾਂ ਉਹਨਾਂ ਪੌਦਿਆਂ ਦੇ ਜਿਹੜਾ ਫਲ ਆਉਂਦਾ ਹੈ ਚਾਹੇ ਉਹ ਸਬਜ਼ੀ ਹੈ ਚਾਹੇ ਉਹ ਫਲ ਫਰੂਟ ਹੈ ਉਹਨਾਂ ਦੀ ਵਰਤੋਂ ਮੈਂ ਰੋਜ਼ਾਨਾ ਆਪਣੀ ਰਸੋਈ ਵਿੱਚ ਕਰਦੀ ਹਾਂ ਉਹਨਾਂ ਤੋਂ ਸਬਜ਼ੀਆਂ ਬਣਾਉਂਦੀ ਹਾਂ ਅਤੇ ਜਿਹੜੇ ਫਲ ਹਨ ਉਹ ਅਸੀਂ ਸਾਰੇ ਜਿਹੜਾ ਪਰਿਵਾਰ ਹੈ ਉਹ ਮਿਲ ਕੇ ਖਾਂਦੇ ਹਨ